ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਸਾਧਾਰਨ ਮਹੌਲ ਜਾਂ ਵਾਤਾਵਰਨ ਤੇ ਬੈਠ ਕੇ ਯੋਗਾ ਅਭਿਆਸ ਕੀਤਾ ਹੈ ਜਿਵੇਂ ਕੀ ਸਾਡੇ ਘਰ ਦੇ ਲਾਗੇ ਹੀ ਇੱਕ ਚੌਂਕ ਦੇ ਵਿੱਚ ਜਾਂ ਇੱਕ ਮਹੱਲੇ ਦੇ ਵਿੱਚ ਤ੍ਰਿਕੋਨਾ ਪਾਰਕ ਹੈ ਜਿਸ ਵਿੱਚ ਇੱਕ ਯੋਗਾ ਅਧਿਆਪਕ ਆਂਦੇ ਹਨ ਤੇ ਓ ਯੋਗਾ ਦਾ ਅਭਿਆਸ ਕਰਾਂਦੇ ਹਨ ਪਰ ਉਹ ਤ੍ਰਿਕੋਨਾ ਪਾਰਕ ਘਰਾਂ ਨਾਲ ਘਿਰਿਆ ਹੋਇਆ ਹੈ ਉਹਦੇ ਆਲੇ ਦੁਆਲੇ ਬਹੁਤ ਸਾਰੇ ਚਾਰੋ ਪਾਸੇ ਘਰ ਹਨ ਤੇ ਲੋਕੀਂ ਆਪਣੇ ਘ ਉਹ ਜਿਹੜੇ ਘਰ ਹਨ ਉਹ ਦੋ ਤਿੰਨ ਮੰਜਿਲਾ ਦੇ ਹਨ ਤੇ ਲੋਕੀਂ ਆਪਣੇ ਘਰ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਦੋ ਤਿੰਨ ਮੰਜਿਲਾਂ ਦੇ ਉੱਤੇ ਚੜ੍ਹ ਕੇ ਸਾਨੂੰ ਵੇਖਦੇ ਸੀ ਤੇ ਮੈਨੂੰ ਬਹੁਤ ਜਿਆਦਾ ਅਜੀਬ ਫੀਲ ਹੁੰਦਾ ਸੀ ਤੇ ਅਜੀਬ ਲੱਗਦਾ ਸੀ ਤੇ ਦੂਜਾ ਜਿਹੜੇ ਜਿੱਦਾਂ ਕੀ ਹੁਣ ਨੋ ਜਿਹੜੇ ਆ ਸਾਧਾਰਨ ਅਸਰ ਹੁੰਦੇ ਹਨ ਜਿਵੇਂ ਕੀ ਹੋ ਗਿਆ ਕਪਾਲਭਾਤੀ ਹੋ ਗਿਆ ਓਦਾਂ ਦੇ ਆਸਣ ਤੇ ਅਸੀਂ ਕਰ ਲਈਦੇ ਸੀਗੇ ਪਰ ਜਿਹੜੇ ਬਾਵਾਂ ਵਾਲੇ ਆਸਣ ਜਾਂ ਫਿਰ ਕੋਈ ਹੋਰ ਆਸਣ ਜਿਹੜੇ ਕੁੜੀਆਂ ਨੂੰ ਨਹੀਂ ਸਹੀ ਲੱਗਦੇ ਸੀ ਕਰਨੇ ਤੇ ਉਹ ਨਹੀਂ ਕਰ ਪਾਂਦੀਆਂ ਸੀ ਕਿਉਂਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਡਰ ਬੈਠ ਜਾਂਦਾ ਸੀ ਵੀ ਲੋਕੀਂ ਉੱਤੇ ਖੜੇ ਹੋ ਕੇ ਸਾਡਾ ਮਜ਼ਾਕ ਨਾ ਉਡਾਂਦੇ ਹੋਣ ਜਾਂ ਫਿਰ ਸਾਡੇ ਵੀ ਵੀਡੀਓ ਜਾਂ ਫੇਰ ਕੋਈ ਸਾਡੀ ਫੋਟੋ ਰਿਕੋਡ ਵਗੈਰਾ ਨਾ ਕਰਦੇ ਹੋਣ ਇਸ ਕਾਰਨ ਜਿਹੜਾ ਉਹ ਯੋਗਾ ਹੈ ਅਭਿਆਸ ਓਥੇ ਬੰਦ ਕੀਤਾ ਗਿਆ ਤੇ ਹਾਂ ਮਤਲਬ ਲੋਕੀਂ ਕਰ ਵੀ ਲੈਂਦੇ ਹਨ ਪਰ ਹਾਂ ਮੇਰਾ ਜਿਹੜਾ ਮਹੌਲ ਐ ਮੈਨੂੰ ਜਿਹੜਾ ਮਹੌਲ ਚਾਈਦਾ ਹੁੰਦਾ ਕੀ ਵਧੀਆ ਜਗ੍ਹਾ ਹੋਵੇ ਓਥੇ ਵਧੀਆ ਤਰੀਕੇ ਦਾ ਸਾਰਾ ਹੋਵੇ ਕੀ ਹਾਂ ਤੁਸੀਂ ਅਰਾਮ ਨਾਲ ਅੰਦਰ ਬੈਠ ਕੇ ਆਪਣਾ ਯੋਗਾ ਕਰ ਪਾਓ ਕਿਉਂਕੀ ਯੋਗਾ ਇੱਕ ਇਹੋ ਜਿਹੀ ਚੀਜ ਐ ਜਿਹੜਾ ਤੁਹਾਨੂੰ ਕਰਨਾ ਹੀ ਚਾਈਦਾ ਹੈ ਰੋਜ਼ਾਨਾ ਤੇ ਜਿਹੜਾ ਬਹੁਤ ਵਧੀਆ ਰਹਿੰਦਾ ਹੈ ਸਿਹਤ ਵਾਸਤੇ ਤੇ ਮੈਂ ਜਿਹੜਾ ਅਸਾ ਅਸਾਧਾਰਨ ਜਗ੍ਹਾ ਤੇ ਬਹਿ ਕੇ ਯੋਗਾ ਕਰਨਾ ਬਿਲਕੁਲ ਵੀ ਪਸੰਦ ਨਈਂ ਕਰਦੀ ਕਿਉਂਕੀ ਮੈਨੂੰ ਬਹੁਤ ਅਜੀਬ ਲੱਗਦਾ ਹੈ ਕਿਉਂਕੀ ਮੈਨੂੰ ਲੋਕਾਂ ਦੇ ਸਾਮਣੇ ਕਈ ਵਾਰੀ ਸ਼ਰਮ ਆਂਦੀ ਐ ਏਸ ਲਈ ਮੈਂ ਨਈਂ ਕਰਦੀ ਤੇ ਹਾਂ ਮੈਂ ਕੀਤਾ ਜਰੂਰ ਐ ਇੱਕ ਦੋ ਵਾਰੀ ਇੱਕ ਦੋ ਵਾਰੀ ਪਰ ਮੈਂ ਪਸੰਦ ਨਈਂ ਕਰੂੰਗੀ ਕਰਨਾ ਧੰਨਵਾਦ